ਇਹ ਯਕੀਨੀ ਬਣਾਉਣ ਲਈ ਕਿ ਨਵਜੰਮੇ ਬੱਚਿਆਂ ਨੂੰ ਸਾਫ ਸੁਥਰਾ ਵਾਤਾਵਰਨ ਹੋਵੇ ਅਤੇ ਅਸਥਿਰ ਹਾਲਤਾਂ ਕਾਰਨ ਬਿਮਾਰੀਆਂ ਤੋਂ ਸੁਰੱਖਿਅਤ ਰੱਖਿਆ ਜਾਵੇ ਕਈ ਉਪਾਅ ਕੀਤੇ ਜਾਣੇ ਚਾਹੀਦੇ ਹਨ ਸਭ ਤੋਂ ਪਹਿਲਾਂ ਸਤਹ ਖਿਡਾਉਣੇ ਅਤੇ ਬਿਸਤਰੇ ਸਮੇਤ ਬੱਚੇ ਦੇ ਰਹਿਣ ਵਾਲੇ ਖੇਤਰ ਨੂੰ ਨਿਯਮਿਤ ਤੌਰ 'ਤੇ ਸਾਫ ਅਤੇ ਰੋਗਾਣੂ ਮੁਕਤ ਕਰਕੇ ਸਖਤ ਸਫਾਈ ਅਭਿਆਸਾਂ ਨੂੰ ਬਣਾਈ ਰੱਖੋ ਬੱਚੇ ਦੇ ਕਮਰੇ ਵਿੱਚ ਸਹੀ ਹਵਾਦਾਰੀ ਅਤੇ ਹਵਾ ਦੀ ਗੁਣਵੱਤਾ ਨੂੰ ਯਕੀਨੀ ਬਣਾਓ ਧੂੰਏ ਜਾਂ ਪ੍ਰਦੂਸ਼ਕਾਂ ਦੇ ਸੰਪਰਕਾਂ ਤੋਂ ਬਚਾਓ ਬੱਚੇ ਨੂੰ ਸੰਭਾਲਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਸਾਫ ਰੋਗਾਣੂ ਮੁਕਤ ਭੋਜਨ ਦੀਆਂ ਬੋਤਲਾਂ ਅਤੇ ਬਰਤਨਾਂ ਦੀ ਵਰਤੋਂ ਕਰੋ ਲਾਗਾਂ ਤੋਂ ਬਚਣ ਲਈ ਨਿਯਮਿਤ ਤੌਰ 'ਤੇ ਬੱਚਿਆਂ ਦੇ ਡਾਈਪਰ ਅਤੇ ਕੱਪੜਿਆਂ ਦੀ ਜਾਂਚ ਕਰੋ ਅਤੇ ਸਾਫ ਕਰੋ ਇਸ ਤੋਂ ਇਲਾਵਾ ਇਹ ਸੁਨਿਸ਼ਚਿਤ ਕਰੋ ਕਿ ਕੋਈ ਵੀ ਦੇਖਭਾਲ ਕਰਨ ਵਾਲੇ ਅਤੇ ਬਿਹਤਰ ਟੀਕਾਕਰਨ 'ਤੇ ਅਪਟੂ ਡੇਟ ਹਨ ਅਤੇ ਚੰਗੀ ਸਫਾਈ ਅਭਿਆਸਾਂ ਦੀ ਪਾਲਣਾ ਕਰਦੇ ਹਨ